ਹੈਲੋ ਹਾਂਜੀ ਮੇਰੀ ਆਵਾਜ਼ ਆ ਰਹੀ ਆ ਤੁਹਾਨੂੰ ਅੱਛਾ ਤੁਸੀਂ ਰਾਜਾ ਬੂਟ ਹਾਊਸ ਤੋਂ ਬੋਲ ਰਹੇ ਹੋ ਅੱਛਾ ਮੈਂ ਸ਼ਮਸ਼ੇਰ ਬੋਲ ਰਿਹਾ ਅੰਗੀ ਤੁਹਾਨੂੰ ਯਾਦ ਹੋਣਾ ਕੁ ਕੁਛ ਦਿਨ ਪਹਿਲਾਂ ਮੈਂ ਤੁਹਾਡੇ ਕੋਲੋਂ ਸਕੈਚਰ ਦੇ ਸ਼ੂਜ ਲੈ ਗਿਆ ਸੀ ਅੱਛਾ ਹਾਂ ਉਹ ਪੱ ਪੱਚੀ ਸੌ ਰੁਪਏ ਦੇ ਲਗਾਏ ਸੀ ਤੁਸੀਂ ਸ਼ੂਜ ਅਤੇ ਉਹ ਉਹਦੇ ਬਾਰੇ ਮੈਂ ਤੁਹਾਡੇ ਕੋਲ ਪੁੱਛਣਾ ਭੁੱਲ ਗਿਆ ਵੀ ਉਹਦੀ ਕੋਈ ਗਰੰਟੀ ਜਾਂ ਵਾਰੰਟੀ ਵਗੈਰਾ ਹੈਗੀ ਹੈ ਜਾਂ ਉਹਨਾਂ 'ਚ ਕੋਈ ਖਰਾਬੀ ਆ ਜਾਂਦੀ ਹੈ ਤਾਂ ਤੁਸੀਂ ਉਹਨੂੰ ਰਿਟਰਨ ਪੋਲਿਸੀ ਵਗੈਰਾ ਤੁਹਾਡੇ ਕੀ ਨੇ ਅੱਛਾ ਅੱਛਾ ਅੱਛਾ ਮਤਲਬ ਕੋਈ ਖਰਾਬ ਹੋ ਜਾਵੇ ਜਾਂ ਜਿਵੇਂ ਸੋਲ ਵਗੈਰਾ ਨਿਕਲ ਜਾਵੇ ਜਾਂ ਕਲਰ ਫੇਂਟ ਹੋ ਜਾਵੇ ਤਾਂ ਉਹਨਾਂ ਦਾ ਰਿਟਰਨ ਪੋਲਿਸੀ ਹੈ

ਅੱਛਾ ਅਤੇ ਉਹਦੇ ਬਾਰੇ ਤੁਸੀਂ ਕੋਈ ਬਿੱਲ ਦੇ ਉੱਪਰ ਤਾਂ ਲਿਖਿਆ ਨਹੀਂ ਹੋਇਆ ਤੁਸੀਂ ਵੱਖਰਾ ਕੋਈ ਗਰੰਟੀ ਕਾਰਡ ਜਾ ਦਿਓਗੇ ਜਾਂ ਬਿਲ ਦੇ ਉੱਪਰ ਹੀ ਲਿਖ ਕੇ ਦੇ ਦਿਓਗੇ ਅੱਛਾ ਵੈਸੇ ਲਿਖਿਆ ਨਹੀਂ ਹੋਇਆ ਫਿਰ ਮੈਂ ਬਿਲ ਤੁਹਾਨੂੰ ਤੁਹਾਡੇ ਕੋਲ ਲੇ ਆਵਾਂਗਾ ਤੁਸੀਂ ਉਹਦੇ 'ਤੇ ਲਿਖ ਦੇਣਾ ਵੀ ਇੱਕ ਸਾਲ ਦੀ ਗਰੰਟੀ ਹੈ

ਮੈਨੂੰ ਇੱਕ ਹ ਡੇਢ ਕੁ ਹਫ਼ਤਾ ਹੋ ਗਿਆ ਜੀ ਯਾਦ ਉਦੋਂ ਯਾਦ ਨਹੀਂ ਰਿਹਾ ਪੁੱਛਣ ਦਾ ਵੈਸੇ ਤਾਂ ਸ਼ੂਜ਼ ਸਹੀ ਨੇ ਪਰ ਮੈਂ ਪੁੱਛਣਾ ਸੀ ਵੀ ਉਹਦੀ ਕੀ ਗਰੰਟੀ ਜਾਂ ਵਰੰਟੀ ਵਗੈਰਾ ਕੀ ਐ ਅਤੇ ਮੈਂਟਨੈਂਸ ਦੀ ਤਾਂ ਕੋਈ ਖ਼ਾਸ ਜ਼ਰੂਰਤ ਨਹੀਂ ਹੁੰਦੀ ਕਿ ਮੈਂਟਨੈਂਸ ਕਰਨੀ ਪੈਂਦੀ ਹੈ ਕੀ ਕਰਨੀ ਪੈਂਦੀ ਉਹ ਕਾਹਦੇ ਵਾਸਤੇ ਅੱਛਾ ਵੈਸੇ ਤਾਂ ਸਪੋਰਟਸ ਸ਼ੂ ਨੇ ਉਹ ਕਦੇ ਨਾ ਕਦੇ ਵਾਸ਼ ਤਾਂ ਕਰਨੇ ਹੀ ਪੈਣਗੇ ਅਤੇ ਵਾਸ਼ੇਬਲ ਸ਼ੂਜ ਨੇ ਠੀਕ ਹੈ ਠੀਕ ਹੈ ਠੀਕ ਹੈ ਅਤੇ ਵਾਸ਼ ਕਰਕੇ ਫਿਰ ਧੁੱ ਧੁੱਪ 'ਚ ਸੁਕਾ ਦੇਣੇ ਅੱਛਾ ਸਿੰਪਲ ਵਾਸ਼ ਹੈ ਜਾਂ ਜਿਵੇਂ ਸਿੰਪਲ ਆਮ ਵਾਸ਼ ਕਰੀਦਾ ਸੋਪ ਨਾਲ ਕਈ ਲੋਕ ਜਿਵੇਂ ਵਾਸ਼ਿੰਗ ਮਸ਼ੀਨ 'ਚ ਪਾ ਦਿੰਦੇ ਨੇ ਉਹ ਤਾਂ ਨਹੀਂ ਪਾਣੇ ਨਾ ਉਸ ਤਰ੍ਹਾਂ ਖਰਾਬ ਹੋ ਜਾਣਗੇ ਅੱਛਾ ਅੱਛਾ ਅੱਛਾ ਮਤਲਬ ਇੱਕ ਸਾਲ ਦੇ ਅੰਦਰ ਅੰਦਰ ਅਗਰ ਸੋਲ ਨਿਕਲ ਜਾਵੇ ਜਾਂ ਕਲਰ ਜਾਂ ਕੋਈ ਹੋਰ ਪ੍ਰੋਬਲਮ ਆਵੇ ਤਾਂ ਤੁਸੀਂ ਉਹਨੂੰ ਉਹ ਆਪਣੇ ਰਿਟਰਨ ਕਰੋਗੇ ਤੁਸੀਂ ਆਪਣੇ ਕੋਲੋਂ ਦੇ ਦਿਓਗੇ ਪੀਸ ਨਵਾਂ ਜਾ ਉਹਨੂੰ ਵਾਪਿਸ ਭੇਜੋਗੇ ਫਿਰ ਵੇਟ ਕਰਨੀ ਪਵੇਗੀ ਅਤੇ ਫਿਰ ਉੱਥੋਂ ਆਣਗੇ ਅੱਛਾ ਇਹਦਾ ਮਤਲਬ ਇਹਦਾ ਮਤਲਬ ਬਿਲ ਸੰਭਾਲ ਕੇ ਰੱਖਣਾ ਪਵੇਗਾ ਇੱਕ ਸਾਲ ਤੱਕ ਅੱਛਾ ਅੱਛਾ ਅੱਛਾ ਹੋਰ ਕਿਸ ਕਿਸ ਕੰਪਨੀ ਦੇ ਵਿੱਚ ਸ਼ੂਜ਼ ਤੁਸੀਂ ਰੱਖਦੇ ਹੋ ਜਿਵੇਂ ਹੋਰ ਮੇਰੇ ਇੱਕ ਫਰੈਂਡ ਨੇ ਵੀ ਲੈਣੇ ਨੇ ਸ਼ੂਜ਼ ਅੱਛਾ ਅੱਛਾ ਅੱਛਾ ਜੀ ਇਹ ਤਾਂ ਸਾਰੀਆਂ ਬਰਾਂਡਿਡ ਕੰਪਨੀਆਂ ਨੇ ਇਹਨਾਂ ਦੇ ਸਭ ਦੀ ਗਰੰਟੀ ਹੈ ਅੱਛਾ ਠੀਕ ਠੀਕ ਹੈ ਠੀਕ ਚੱਲੋ ਜੀ ਠੀਕ ਹੈ ਥੈਂਕ ਯੂ ਜੀ ਬਸ ਇਹ ਹੀ ਪੁੱਛਣਾ ਸੀ ਇਸ ਵਾਸਤੇ ਫੋਨ ਕੀਤਾ ਸੀ ਠੀਕ ਹੈ ਜੀ ਥੈਂ ਥੈਂਕ ਯੂ ਜੀ